ਹੈਲੋ ਹਾਂਜੀ ਮੈਂ ਨਾ ਤੁਹਾਡੀ ਦੁਕਾਨ ਤੋਂ ਅਰੋੜਾ ਜਰਨਲ ਸਟੋਰ ਤੋਂ ਨਾ ਸਮਾਨ ਮੰਗਾਇਆ ਸੀ ਕਿ ਤੁਸੀਂ ਉਥੋਂ ਗੱਲ ਕਰ ਰਹੇ ਹੋ ਅਤੇ ਨਾ ਮੈਂ ਕਾਫੀ ਸਾਰੀਆਂ ਚੀਜ਼ਾਂ ਮੰਗਵਾਈਆਂ ਸੀ ਗਰੋਸਰੀ ਦੀਆਂ ਜਿਹਨਾਂ ਵਿੱਚ ਕਿ ਮੈਨੇ ਸੂਜੀ ਦੇ ਪੈਕਟ ਮੰਗਵਾਏ ਸੀ ਅਤੇ ਮੈਨੇ ਕੋਕ ਮੰਗਵਾਈ ਸੀਗੀ ਅਤੇ ਇੱਕ ਮੈਨੇ ਮੈਗੀ ਦੇ ਪੈਕਟ ਮੰਗਵਾਏ ਸੀ ਅਤੇ ਉਹਦੇ ਵਿੱਚ ਨਾ ਮੈਨੇ ਕੀ ਹੈ ਕਾਫੀ ਸਾਰੇ ਮਸਾਲੇ ਵੀ ਮੰਗਵਾਏ ਸੀਗੇ ਇੱਕ ਮੈਗੀ ਮਸਾਲਾ ਸੀਗਾ ਇੱਕ ਮੈਕਰੋਨੀ ਸੀ ਇੱਕ ਪਾਸਤਾ ਵੀ ਸੀ ਜਿਹਦੇ ਵਿੱਚ ਨਾ ਮੇਰਾ ਕੀ ਹੈ ਜਿਹੜੇ ਮੈਗੀ ਦੇ ਪੈਕਟ ਨੇ ਨਾ ਉਹਨਾਂ ਦੀ ਡੇਟਾਂ ਕੀ ਹੈ ਐਕਸਪਾਇਰ ਹੋਈ ਹੋਈ ਸੀ ਅਤੇ ਨਾ ਉਹ ਮੈਂ ਰਿਪਲੇਸ ਕਰਨੇ ਨੇ ਗੇ ਕਿਉਂਕਿ ਹੁਣ ਉਹ ਖਾਣ ਲਾਇਕ ਤਾਂ ਹੈ ਨਹੀਂ ਫਿਰ ਤੁਸੀਂ ਰਿਪਲੇਸ ਕਰੋਗੇ ਇੱਕ ਉਹਨਾਂ ਵਿੱਚੋਂ ਮੈਨੇ ਖੋਲ੍ਹ ਲਿਆ ਸੀ ਪਰ ਜਦੋਂ ਮੈਨੂੰ ਬਾਅਦ 'ਚ ਪਤਾ ਲੱਗਿਆ ਨਾ ਕੁਕ ਕਰਨ ਤੋਂ ਬਾਅਦ ਤਾਂ ਉਹਨਾਂ ਦਾ ਟੇਸਟ ਵੀ ਬੜਾ ਗੰਦਾ ਜਿਹਾ ਆਇਆ ਤਾਂ ਕਰਕੇ ਉਹਨਾਂ ਨੂੰ ਮੈਂ ਨਾ ਹੁਣ ਰਿਪਲੇਸ ਕਰਨਾ ਹੈ ਅਤੇ ਇੱਕ ਜਿਹੜੀ ਸੂਜੀ ਦੇ ਪੈਕਟ ਸੀ ਨਾ ਉਹਦੇ ਵਿੱਚ ਵੀ ਕੀੜੇ ਨੇਗੇ ਉਹ ਵੀ ਰਿਪਲੇਸ ਕਰਨੀ ਤੁਹਾਡੀ ਰਿਪਲੇਸਮੈਂਟ ਰਿਪਲੇਸਮੈਂਟ ਪੋਲਿਸੀ ਹੈ ਜਿਹੜੀ ਹੈਗੀ ਹੈ ਇਹਦੇ ਵਿੱਚ ਮੈਨੇ ਨਾ ਕਾਫੀ ਪੈਕਟ ਮੈਨੇ ਖੋਲ੍ਹ ਵੀ ਲਏ ਸੀ ਠੀਕ ਹੈ ਥੈਂਕ ਯੂ ਜੀ